ਖੇਡਾਂ ਜਿਵੇਂ ਕਿ ਪੁਰਾਣੀਆਂ ਖੇਡਾਂ ਦੇ ਵਿੱਚ ਬਹੁਤ ਸਾਰੀਆਂ ਖੇਡਾਂ ਬਚਪਨ ਤੋਂ ਹੀ ਖੇਡਣੀਆਂ ਸ਼ੁਰੂ ਹੋ ਜਾਂਦੀਆਂ ਸਨ ਪੀਚੋ ਬੱਕਰੀ ਬਾਂਦਰ ਕਿੱਲਾ ਰੱਸੀ ਟੱਪਣਾ ਅਤੇ ਇਸ ਤਰ੍ਹਾਂ ਦੀਆਂ ਖੇਡਾਂ ਨਾਲ ਜਿਹੜਾ ਬੱਚਿਆਂ ਦਾ ਸੀਗਾ ਸਰੀਰਕ ਮਾਨਸਿਕ ਵਿਕਾਸ ਹੁੰਦਾ ਸੀ ਖੇਡਾਂ ਦੇ ਨਾਲ ਸਾਡੇ ਵਿੱਚ ਇਕਾਗਰਤਾ ਠੀਕ ਹੈ ਜੀ ਸਾਰਿਆਂ ਨਾਲ ਮਿਲ ਕੇ ਰਹਿਣ ਦੀ ਭਾਵਨਾ ਊਚ ਨੀਚ ਦੀ ਭਾਵਨਾ ਖਤਮ ਹੁੰਦੀ ਹੈ ਕਿਉਂਕਿ ਜਦੋਂ ਅਸੀਂ ਖੇਡਾਂ ਦੇ ਵਿੱਚ ਭਾਗ ਲੈਂਦੇ ਹਾਂ ਤਾਂ ਉਸ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਭੇਦਭਾਵ ਨਹੀਂ ਹੁੰਦਾ ਜਸਟ ਖਿਡਾਰੀ ਹੀ ਹੁੰਦਾ ਹੈ ਜੋ ਕਿ ਖੇਡਾਂ ਖੇਡਦਾ ਹੈ ਅਤੇ ਇਸ ਦੇ ਨਾਲ ਸਾਡਾ ਮਾਨਸਿਕ ਸਰੀਰਕ ਆਰਥਿਕ ਵਿਕਾਸ ਹੁੰਦਾ ਹੈ